ਹਾਂਜੀ ਸਰਦਾਰ ਰਣਇੰਦਰ ਸਿੰਘ ਜੀ ਬੋਲ ਰਹੇ ਆ ਇਰੀਗੇਸ਼ਨ ਡਿਪਾਰਟਮੈਂਟ ਤੋਂ ਸਰ ਮੈਂ ਜੰਗ ਬਹਾਦਰ ਸਿੰਘ ਬੋਲ ਰਿਹਾ ਜੀ ਓਂਕਾਰ ਚੈਨਲ ਤੋਂ ਸਰ ਮੈਂ ਤੁਹਾਡੇ ਤੋਂ ਅਪ ਪਿਛਲੇ ਸਾਲ ਤੁਹਾਡੇ ਏਰੀਏ ਦੇ ਵਿੱਚ ਆਏ ਹੜ੍ਹਾਂ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਕਰਨਾ ਚਾਹੁੰਦਾ ਵੀ ਕੀ ਮੈਂ ਜਾਣ ਸਕਦਾ ਕਿ ਤੁਸੀਂ ਇਸ ਫੀਲਡ ਦੇ ਵਿੱਚ ਕਦੋਂ ਤੋਂ ਜੋ ਜੋਬ ਕਰ ਰਹੇ ਹੋ ਠੀਕ ਹੈ ਇਸ ਏਰੀਏ ਦੇ ਵਿੱਚ ਤੁਹਾਨੂੰ ਤਿੰਨ ਸਾਲ ਹੋ ਗਏ ਨੌਕਰੀ ਕਰਦਿਆਂ ਨੂੰ ਸਰ ਕੀ ਇਹ ਤਿੰਨ ਸਾਲਾਂ ਦੇ ਵਕਤ ਦੇ ਵਿੱਚ ਇਹ ਪਹਿਲੀ ਵਾਰ ਹੜ੍ਹ ਆਏ ਜਾਂ ਇਸ ਤੋਂ ਪਹਿਲਾਂ ਲਗਾਤਾਰ ਹਰ ਸਾਲ ਹੀ ਇਹ ਹੜ੍ਹ ਆਉਂਦੇ ਨੇ ਤੁਹਾਨੂੰ ਪਤਾ ਹੋਵੇ ਸਰ ਜਿੱਥੋਂ ਤੱਕ ਜਾਣਕਾਰੀ ਹੈ ਤੁਹਾਡੇ ਖੇਤਰ ਦੇ ਵਿੱਚ ਮੀਂਹ ਬਹੁਤ ਘੱਟ ਪਏ ਪਰ ਹੜ੍ਹ ਹੈ ਜਿਹੜੇ ਉਹਨਾਂ ਕਾਰਨ ਨੁਕਸਾਨ ਬਹੁਤ ਹੋਇਆ ਕੀ ਇਹ ਪਾਣੀ ਤੁਸੀਂ ਕੀ ਸਮਝਦੇ ਹੋ ਵੀ ਇੰਨਾ ਪਾਣੀ ਇਕੱਠਾ ਕਿੱਥੋਂ ਆ ਗਿਆ ਸਰ ਸਾਨੂੰ ਕੁਝ ਰਿਪੋਰਟਾਂ ਇਸ ਤਰ੍ਹਾਂ ਦੀਆਂ ਪ੍ਰਾਪਤ ਹੋਈਆਂ ਫੀਲਡ ਵਿੱਚੋਂ ਇਹ ਸੰਬੰਧਿਤ ਜੋ ਡੈਮ ਦੀ ਮੈਨੇਜਮੈਂਟ ਹੈ ਉਹਨਾਂ ਵੱਲੋਂ ਸਮੇਂ ਸਿਰ ਡੈਮ ਦੇ ਵਿੱਚੋਂ ਪਾਣੀ ਨਹੀਂ ਛੱਡਿਆ ਗਿਆ ਜਿਸ ਕਾਰਨ ਮੀਂਹ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਗਿਆ ਅਤੇ ਫਿਰ ਉਹਨਾਂ ਨੇ ਬਿਨਾ ਕੋਈ ਸੂਚਨਾ ਦੇ ਇੱਕੋ ਲਗਤ ਪਾਣੀ ਹੈ ਜਿਹੜਾ ਉਹ ਛੱਡ ਦਿੱਤਾ ਜਿਸ ਕਾਰਨ ਹੜ੍ਹ ਆਏ ਕੀ ਇਹ ਸੂਚਨਾ ਸਹੀ ਹੈ ਕੀ ਸਰ ਅੱਗੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਤੋਂ ਜੋ ਨੁਕਸਾਨ ਹੋਇਆ ਉਹਨਾਂ ਤੋਂ ਬਚਾਉਣ ਲਈ ਲੋਕਾਂ ਨੂੰ ਸਰਕਾਰ ਵੱਲੋਂ ਕੋਈ ਰਣਨੀਤੀ ਖਾਸ ਰਣਨੀਤੀ ਤਿਆਰ ਕੀਤੀ ਗਈ ਹੈ ਅਤੇ ਅ ਆਖਰੀ ਪ੍ਰਸ਼ਨ ਸਰ ਕੀ ਪਿਛਲੇ ਸਾਲ ਜੋ ਹੜ੍ਹਾਂ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਕੀ ਉਹਨਾਂ ਸਾਰੇ ਲੋਕਾਂ ਨੂੰ ਬਣਦਾ ਮੁਆਵਜ਼ਾ ਉਹ ਸਰਕਾਰ ਵੱਲੋਂ ਜਾਰੀ ਹੋ ਚੁੱਕਿਆ ਜਾਂ ਨਹੀਂ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਓਕੇ ਸਰ